ਵਾਤਾਵਰਨ ਦੀ ਸੰਭਾਲ ਲਈ ਸ਼ਹੀਦ ਭਗਤ ਸਿੰਘ ਜ਼ਿਲ੍ਹੇ ਵਿੱਚ ਬਹੁਤ ਸਾਰੀਆਂ ਪਹਿਲ ਕਦਮੀਆਂ ਲਈਆਂ ਗਈਆਂ ਹਨ ਜਿੱਦਾਂ ਕਿ ਹੁਣੇ ਸਾਨੂੰ ਪਤਾ ਹੈ ਕਿ ਅਸੀਂ ਹੜ੍ਹਾਂ ਦੀ ਹੜ੍ਹਾਂ ਦੀ ਸਿਚੁਏਸ਼ਨ ਤੋਂ ਰੂਬਰੂ ਹੋਏ ਹਾਂ ਅਤੇ ਉਨ੍ਹਾਂ ਦੇ ਨਾਲ ਕੀ ਹੋਇਆ ਹੈ ਕਿ ਬਹੁਤ ਸਾਰੇ ਲੋਕਾਂ ਦੇ ਘਰ ਜਿਹੜੇ ਆ ਉਹ ਹੜ੍ਹ ਗਏ ਆ ਪੁਲ ਟੁੱਟ ਗਏ ਆ ਬਹੁਤ ਸਾਰੇ ਲੋਕੀਂ ਘਰੋਂ ਬੇਘਰ ਹੋ ਗਏ ਆ ਅਤੇ ਉਨ੍ਹਾਂ ਨੂੰ ਪੁਲਾਂ ਨੂੰ ਬਣਾਉਣ ਦੇ ਲਈ ਜਿਹੜੀ ਇੱਕ ਮਨਰੇਗਾ ਸਕੀਮ ਚਲਾਈ ਗਈ ਸੀਗੀ ਸਾਡੀ ਸੈਂਟਰਲ ਸਰਕਾਰ ਦੇ ਵੱਲੋਂ ਉ ਉਹਨੂੰ ਲਿਆ ਗਿਆ ਹੈ ਅਤੇ ਉਸ ਨੂੰ ਲੈ ਕੇ ਜੋ ਜੋ ਵੀ ਬਣਦੀ ਕਾਰਵਾਈ ਸੀ ਉਹ ਕੀਤੀ ਗਈ ਜਿਵੇਂ ਕਿ ਪੁਲ ਨਵੇਂ ਬਣਾਏ ਗਏ ਹਨ ਜੋ ਜਿਹੜੇ ਘਰੋਂ ਬੇਘਰ ਹੋਏ ਸੀਗੇ ਉਨ੍ਹਾਂ ਨੂੰ ਜੋ ਵੀ ਬਣਦਾ ਉਨ੍ਹਾਂ ਦਾ ਰੁਜ਼ਗਾਰ ਦੁਬਾਰਾ ਤੀ ਰੁਜ਼ਗਾਰ ਦੁਬਾਰਾ ਤੋਂ ਚਲਾਉਣ ਦੇ ਲਈ ਜੋ ਵੀ ਉਨ੍ਹਾਂ ਦਾ ਮੁਆਵਜ਼ਾ ਬਣਦਾ ਸੀ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਗਿਆ ਜਿਨ੍ਹਾਂ ਦੀਆਂ ਫਸਲਾਂ ਹੈ ਜਿਹਨਾਂ ਦੀਆਂ ਫਸਲਾਂ ਡੁੱਬੀਆਂ ਸੀ ਹੜ੍ਹਾਂ ਨਾਲ ਉਹਨਾਂ ਨੂੰ ਉਨ੍ਹਾਂ ਦੀ ਫਸਲਾਂ ਦਾ ਮੁਆਵਜ਼ਾ ਦਿੱਤਾ ਗਿਆ ਹੈ ਇਹ ਤੋਂ ਇਲਾਵਾ ਜਿਹੜੀ ਸਾਡੀ ਪੰਜਾਬੀ ਸਰਕਾਰ ਹੈ ਉਹ ਬਹੁਤ ਸਾਰੇ ਇਹੋ ਜਿਹੇ ਹੋਰ ਵੀ ਸਕੀਮਾਂ ਲੈ ਕੇ ਆ ਰਹੀਂ ਆ ਜਿਵੇਂ ਕਿ ਸਾਡੇ ਹਰ ਇੱਕ ਪੰਜਾਬ ਦਾ ਜਿਹੜਾ ਹਰ ਇੱਕ ਪਿੰਡ ਹੈ ਹਰ ਇੱਕ ਪਿੰਡ ਦੇ ਵਿੱਚ ਵਾਤਾਵਰਨ ਨੂੰ ਬਚਾਉਣ ਦੇ ਲਈ ਪੌਦੇ ਲਗਾਏ ਜਾ ਰਹੇ ਹਨ ਇੱਕ ਪਾਰਕਾਂ ਬਣਾਈਆਂ ਜਾ ਰਹੀਆਂ ਹਨ ਬੱਚਿਆਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਜਿੱਥੇ ਕਿ ਜਾਂਦੇ ਸਾਰੇ ਬ ਬਜ਼ੁਰਗ ਨੇ ਉਹ ਵੀ ਜਾਂਦੇ ਨੇ ਬੱਚੇ ਵੀ ਜਾਂਦੇ ਨੇ ਇੱਕ ਤਾਂ ਜਦੋਂ ਅਸੀਂ ਖੁੱਲ੍ਹੇ ਮਾਹੌਲ ਵਿੱਚ ਜਾਵਾਂਗੇ ਸਾਡ ਸਾਡਾ ਜਿਹੜਾ ਸਰੀਰ ਹੈ ਉਹ ਤੰਦਰੁਸਤ ਬਣੇਗਾ ਅਸੀਂ ਵਾਤਾਵਰਨ ਦੇਖਾਂਗੇ ਉਹਨਾਂ ਦੀ ਸੰਭਾਲ ਕਰਾਂਗੇ ਜੇ ਅਸੀਂ ਅੱਜ ਅਸੀਂ ਅੱਜ ਇੱਕ ਪੌਦਾ ਲਗਾਵਾਂਗੇ ਤਾਂ ਕੱਲ੍ਹ ਨੂੰ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹ ਦਸ ਪੌਦੇ ਲਗਾਉਗੀ ਅਤੇ ਇਸ ਨਾਲ ਕੀ ਆ ਸਾਡਾ ਜਿਹੜਾ ਵਾਤਾਵਰਨ ਆ ਉਹ ਹੋਰ ਵੀ ਵਧੀਆ ਹੋਵੇਗਾ